ਪੰਜਾਬੀ ਭੰਗੜਾ ਮੇਰਾ ਬਹੁਤ ਹੀ ਜ਼ਿਆਦਾ ਮਨ ਪਸੰਦ ਲੋਕ ਨਾਚ ਹੈ ਮੇਰੀ ਬਹੁਤ ਮਨ ਪਸੰਦ ਔਰਬਿੱਕ ਕਲਾਸਾਂ ਵਿੱਚ ਇੱਕ ਭੰਗੜਾ ਕਲਾਸ ਆਉਂਦੀ ਹੈ ਇੱਕ ਵਾਰ ਅਸੀਂ ਪ੍ਰੋਗਰਾਮ ਕੀਤਾ ਸੀਗਾ ਜੋ ਕਿ ਬਹੁਤ ਵਧੀਆ ਰਿਹਾ ਕਿ ਮੇਰੇ ਸਾਰੇ ਦੋਸਤਾਂ ਨੇ ਦੇਖਿਆ ਇਸ ਦੇ ਨਾਲ ਸਾਡੀ ਟੀਮ ਨੂੰ ਵੀ ਬਹੁਤ ਜ਼ਿਆਦਾ ਉੱਦਮਤਾ ਦਾ ਪ੍ਰਾਪਤ ਹੋਈ ਸਾਨੂੰ ਇਸ ਭੰਗੜੇ ਵਿੱਚ ਇਹ ਪਹਿਲਾ ਇਨਾਮ ਮਿਲਿਆ ਸੀ ਜੋ ਕਿ ਅੱਜ ਤੱਕ ਯਾਦਗਾਰ ਬਣ ਗਿਆ ਹੈ ਮੁੰਬਈ ਦੇ ਵਿੱਚ ਸਾਡਾ ਭੰਗੜਾ ਹੋਇਆ ਸੀ ਇਹ ਇਸਦੇ ਭੰਗੜੇ ਦੇ ਨਾਲ ਆਪਣੀ ਬਾਡੀ ਲਚਕੀਲੀ ਰਹਿੰਦੀ ਹਨ ਅਤੇ ਬੰਦਾ ਸਵਸਥ ਰਹਿੰਦਾ ਹੈ ਆਪਾਂ ਨੂੰ ਭੰਗੜਾ ਕਰਨਾ ਹੀ ਚਾਹੀਦਾ ਹੈ ਕਿਉਂਕਿ ਹਰ ਇੱਕ ਫੰਕਸ਼ਨ 'ਤੇ ਭੰਗੜਾ ਬਹੁਤ ਜ਼ਿਆਦਾ ਜਚਦਾ ਹੈ ਇਸ ਦੇ ਨਾਲ ਟੋਰ ਸ਼ੋਰ ਵੀ ਬਣਦੀ ਹੈ ਬੰਦੇ ਦੀ ਬਹੁਤ ਜ਼ਿਆਦੇ ਹੁੰ ਵਧੀਆ ਹੁੰਦਾ ਹੈ ਭੰਗੜਾ ਇਹ ਪੰਜਾਬੀਆਂ ਦਾ ਲੋਕ ਨਾਚ ਹੈ ਪੰਜਾਬੀ ਲੋਕ ਨਾਚ ਦੇ ਵਿੱਚ ਭੰਗੜਾ ਆਉਂਦਾ ਹੈ ਜੋ ਕਿ ਬਹੁਤ ਵਧੀਆ ਹੁੰਦਾ ਹੈ ਇਸ ਦੇ ਨਾਲ ਵਧੀਆ ਵਧੀਆ ਸਖ਼ਤ ਲਚਕੀਲੀ ਬਾਡੀ ਰਹਿੰਦੀ ਆਪਣੀ ਸਰੀਰ ਰਹਿੰਦਾ ਹੈ ਭੰਗੜਾ ਇੱਕ ਬਹੁਤ ਹੀ ਜ਼ਿਆਦੇ ਵਧੀਆ ਲੋਕ ਨਾਚ ਹੈ ਇਹ ਇੱਕ ਵਾਰ ਅਸੀਂ ਮੁੰਬਈ ਦੇ ਵਿੱਚ ਵੀ ਇੱਕ ਦੂਜਾ ਪ੍ਰੋਗਰਾਮ ਕੀਤਾ ਸੀਗਾ ਪੂਨੇ ਦੇ ਵਿੱਚ ਮੁੰਬਈ ਦੇ ਨਾਲ ਹੈ ਜੋ ਕਿ ਬਹੁਤ ਵਧੀਆ ਰਿਹਾ ਉੱਥੇ ਸਾਨੂੰ ਦੂਜਾ ਪ ਉੱਥੇ ਸਥਾਨ ਸਾਨੂੰ ਪ੍ਰਾਪਤ ਹੋਇਆ ਜੋ ਕਿ ਸਾਨੂੰ ਬਹੁਤ ਯਾਦਗਾਰ ਰਿਹਾ ਹੈ ਭੰਗੜੇ ਦੀ ਕਲਾਸਾਂ ਮੈਨੂੰ ਬਹੁਤ ਜ਼ਿਆਦੇ ਪਸੰਦ ਹਨ ਭੰਗੜਾ ਅੱਜ ਅੱਜ ਦੇ ਸਮੇਂ ਦੇ ਵਿੱਚ ਵਿਆਹਾਂ 'ਚ ਵੀ ਭੰਗੜਾ ਹੀ ਬਹੁਤ ਪਸੰਦ ਕੀਤਾ ਜਾਂਦਾ ਹੈ ਭੰਗੜਾ ਇਕ ਇਹ ਜਿਹਾ ਨਾਚ ਹੈ ਜੋ ਕਿ ਹਰ ਕਿਸੇ ਨੂੰ ਪਸੰਦ ਆਉਂਦਾ ਹੈ ਬਾਹਰਲੇ ਇੰਟਰਨੈਸ਼ਨਲ ਲੈਵਲ 'ਤੇ ਵੀ ਭੰਗੜਾ ਕੀਤਾ ਜਾਂਦਾ ਹੈ ਜੋ ਕਿ ਮੈਨੂੰ ਬਹੁਤ ਪਸੰਦ ਹੈ ਮੈਂ ਵੀ ਇੰਟਰਨੈਸ਼ਨਲ ਜਾਣਾ ਚਾਹੁੰਦਾ ਹਾਂ ਭੰਗੜੇ ਦੇ ਰਾਹੀਂ ਇਸ ਕਰਕੇ ਮੈਂ ਭੰਗੜਾ ਕਰਦਾ ਹਾਂ ਭੰਗੜਾ ਮੈਨੂੰ ਬਹੁਤ ਜ਼ਿਆਦੇ ਪਸੰਦ ਹੈ ਮੈਂ ਇੱਕ ਵਾਰ ਇੰਟਰਨੈਸ਼ਨਲ ਟੀਮ ਨੂੰ ਦੇਖਿਆ ਸੀਗਾ ਜੋ ਕਿ ਭੰਗੜਾ ਇਹ ਕੈਨੇਡਾ 'ਚ ਕਰ ਰਹੇ ਸੀ ਉਹਨਾਂ ਨੂੰ ਬਹੁਤ ਜ਼ਿਆਦੇ ਉੱਦਮਤਾ ਮਿਲੀ ਬਾਹਰਲੇ ਦੇਸ਼ਾਂ 'ਚ ਬਹੁਤ ਜ਼ਿਆਦੇ ਪਸੰਦ ਕੀਤਾ ਗਿਆ ਭੰਗੜਾ ਉਹਨਾਂ ਨੂੰ ਪਹਿਲਾ ਇ ਇਨਾਮ ਮਿਲਿਆ ਉਹਨਾਂ ਦੇ ਕੈਨੇਡਾ ਵਿੱਚ ਵੀ ਹੋਰ ਵੀ ਡਾਂਸ ਸੀ ਪਰ ਆਪਣੇ ਭੰਗੜੇ ਨੂੰ ਪਹਿਲਾ ਇਨਾਮ ਮਿਲਿਆ